ਸੰਗੀਤ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹੈ ਸਾਨੂੰ ਇਹ ਬਹੁਤ ਸਮੇਂ 'ਤੇ ਬਹੁਤ ਵੱਖਰੇ ਵੱਖਰੇ ਤਰੀਕੇ ਨਾਲ ਬਹੁਤ ਸਹਿਯੋਗ ਕਰਦਾ ਹੈ ਜਿਵੇਂ ਕਿ ਅਗਰ ਅਸੀਂ ਕਿਸੇ ਟੈਂਸ਼ਨ ਵਿੱਚ ਹੋਈਏ ਜਾਂ ਸਟ੍ਰੈੱਸ ਵਿੱਚ ਹੋਈਏ ਤਾਂ ਹਮੇਸ਼ਾ ਅਸੀਂ ਸੰਗੀਤ ਦਾ ਹੀ ਹੀ ਸਹਾਰਾ ਲੈਂਦੇ ਹਾਂ ਸੰਗੀਤ ਸਾਡੇ ਉਸ ਸਮੇਂ ਵਿੱਚ ਸਾਡਾ ਬਹੁਤ ਸਾਥ ਦਿੰਦਾ ਹੈ ਕਿਉਂਕਿ ਸੰਗੀਤ ਸੁਣਨ ਨਾਲ ਸਾਡੇ ਮਾਨਸਿਕ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਅਤੇ ਕਦੇ ਕਦੇ ਜਦੋਂ ਅਸੀਂ ਵਿਆਹ ਸ਼ਾਦੀਆਂ ਵਿੱਚ ਜਾਂਦੇ ਹਾਂ ਅਤੇ ਖੁਸ਼ੀ ਦੇ ਮੌਕੇ ਵੀ ਸੰਗੀਤ ਦਾ ਸਹਾਰਾ ਲੈਂਦੇ ਹਾਂ ਆਪਣੀ ਖੁਸ਼ੀ ਨੂੰ ਇਜ਼ਹਾਰ ਕਰਨ ਲਈ ਕਿਉਂਕਿ ਸੰਗੀਤਾਂ 'ਤੇ ਅਸੀਂ ਨੱਚਦੇ ਹਾਂ ਬੋਲਦੇ ਹਾਂ ਸਭ ਕੁਛ ਇਸ ਕਰਕੇ ਸੰਗੀਤ ਮੇਰਾ ਬਹੁਤ ਹੀ ਪਸੰਦੀਦਾ ਵਿਸ਼ੇ ਹੈ ਸੰਗੀਤ ਸੰਗੀਤ ਸੁਣਨ ਵਿੱਚ ਗਾਉਣ ਵਿੱਚ ਹਰ ਤਰੀਕੇ ਨਾਲ ਬਹੁਤ ਵਧੀਆ ਲੱਗਦਾ ਹੈ ਅਤੇ ਸੰਗੀਤ ਦੇ ਬਹੁਤ ਪ੍ਰਕਾਰ ਹੁੰਦੇ ਹਨ ਵੱਖਰੇ ਵੱਖਰੇ ਪ੍ਰਕਾਰ ਵੱਖਰੇ ਵੱਖਰੇ ਚੀਜ਼ਾਂ ਸਥਾਨ ਅਤੇ ਪਰਸ ਵਿਅਕਤੀ ਦੇ ਹਿਸਾਬ ਨਾਲ ਵਰਤੇ ਜਾਂਦੇ ਹਨ ਮੈਂ ਚਾਹੁੰਦਾ ਸੀ ਕਿ ਮੈਂ ਸੰਗੀਤ ਦੀ ਦੁਨੀਆ ਵਿੱਚ ਇੱਕ ਬਹੁਤ ਵੱਡਾ ਸਥਾਨ ਬਣਾਵਾਂ ਪਰ ਘਰ ਦੀ ਸਥਿਤੀ ਹੁਣ ਕ ਨਹੀਂ ਹੋਣ ਕਰਕੇ ਓਨੀ ਵਧੀਆ ਮੈਂ ਇਹਨੂੰ ਨਹੀਂ ਚੁਣਿਆ ਪਰ ਜਦੋਂ ਵੀ ਭਵਿੱਖ ਵਿੱਚ ਮੈਨੂੰ ਇਹ ਮੌਕਾ ਲੱਗੇ ਕਿ ਮੈਂ ਇਸ ਵਿੱਚ ਆਪਣੀ ਜ਼ਿੰਦਗੀ ਵਿੱਚ ਕੁਛ ਕਰ ਸਕਦਾ ਹਾਂ ਤਾਂ ਮੈਂ ਹਮੇਸ਼ਾ ਚਾਹਵਾਂਗਾ ਕਿ ਮੈਂ ਕੁਝ ਵਧੀਆ ਕਰਾਂ ਜਦਕਿ ਮੈਨੂੰ ਸੰਗੀਤ ਇੱਕ ਬਹੁਤ ਹੀ ਪਿਆਰਾ ਸਬਜੈਕਟ ਲੱਗਦਾ ਹੈ ਜਿਵੇਂ ਕਿ ਸਤਿੰਦਰ ਸਰਤਾਜ ਜੀ ਜੋ ਇਹਨਾਂ ਨੂੰ ਕਿ ਮੈਂ ਆਪਣਾ ਉਸਤਾਦ ਮੰਨਦਾ ਹਾਂ ਉਹ ਸੰਗੀਤ ਨੂੰ ਇੱਕ ਇਮੋਸ਼ਨ ਦੀ ਤਰ੍ਹਾਂ ਜੀਂਦੇ ਹਨ ਅਤੇ ਉਹ ਜੋ ਵੀ ਗਾਣਾ ਲਿਖਦੇ ਹਨ ਉਹਦੇ ਹਰ ਇੱਕ ਬੋਲ ਅੱਖਰ ਹਰ ਇੱਕ ਦਾ ਆਪਣਾ ਇੱਕ ਮਤਲਬ ਹੁੰਦਾ ਹੈ ਜਿਹਦਾ ਬਹੁਤ ਗਹਿਰਾਈ ਤੱਕ ਸਮਝਣ ਦੀ ਜ਼ਰੂਰਤ ਹੁੰਦੀ ਹੈ ਅਤੇ ਮੈਂ ਹਮੇਸ਼ਾ ਉਹਨਾਂ ਦੇ ਗਾਣਿਆਂ ਨੂੰ ਬਹੁਤ ਲੰਬੇ ਲੰਬੇ ਸਮੇਂ ਤੱਕ ਅਤੇ ਬਹੁਤ ਇੰਟਰਸਟ ਨਾਲ ਸੁਣਦਾ ਹਾਂ ਅਤੇ ਮੈਂ ਚਾਹੁੰਦਾ ਹਾਂ ਕਿ ਮੈਂ ਵੀ ਕੁਝ ਇਸ ਤਰ੍ਹਾਂ ਦਾ ਹੀ ਲਿਖਾਂ ਕਿ ਲੋਕ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਸੁਣਨ ਹਾਲੇ ਤਾਂ ਮੈਂ ਆਪਣੀ ਪੜ੍ਹਾਈ ਲਿਖਾਈ ਪੂਰੀ ਕਰ ਰਿਹਾ ਹਾਂ ਪਰ ਜਦੋਂ ਮੇਰੀ ਪੜ੍ਹਾਈ ਲਿਖਾਈ ਪੂਰੀ ਹੋ ਜਾਂਦੀ ਹੈ ਤਾਂ ਮੈਂ ਚਾਹੁੰਦਾ ਹਾਂ ਕਿ ਮੈਂ ਵੀ ਕੁਝ ਐਸਾ ਕਰਾਂ ਇਹ ਸੰਗੀਤ ਦੀ ਦੁਨੀਆ ਵਿੱਚ ਕਿ ਲੋਕ ਮੇਰਾ ਨਾਮ ਹਮੇਸ਼ਾ ਬਹੁਤ ਲੰਬੇ ਲੰਬੇ ਸਮੇਂ ਤੱਕ ਯਾਦ ਰੱਖਣ ਮੇਰੇ ਪਸੰਦੀਦਾ ਸਿੰਗਰਾਂ ਵਿੱਚੋਂ ਇੱਕ ਹਨ ਸਤਿੰਦਰ ਸਰਤਾਜ ਇੱਕ ਹਨ ਕਾਕਾ ਜੀ ਅਤੇ ਇੱਕ ਹੋਰ ਬਹੁਤ ਵਧੀਆ ਨੁਸਰਤ ਫਤਿਹ ਅਲੀ ਸਾਹਿਬ ਹਨ ਸੰਗੀਤ ਦੇ ਬਹੁਤ ਵੱਖਰੇ ਵੱਖਰੇ ਪ੍ਰਕਾਰ ਹਨ ਅਤੇ ਮੈਂ ਚਾਹੁੰਦਾ ਹਾਂ ਕਿ ਮੈਂ ਸੰਗੀਤ ਨੂੰ ਜਿੰਨਾ ਤਰਾਸ਼ ਸਕਦਾ ਹਾਂ ਜਿੰਨਾ ਉਹਦੀ ਗਹਿਰਾਈ ਤੱਕ ਜਾ ਸਕਦਾ ਹਾਂ ਮੈਂ ਜਾਣ ਦਾ ਪ੍ਰਯਾਸ ਕਰਾਂ